ਹਾਈਕਿੰਗ ਦੌਰਾਨ ਸਾਡੇ ਕੋਲ ਫਸਟ ਏਡ ਕਿੱਟ ਹੋਣੀ ਬਹੁਤ ਜਰੂਰੀ ਹੈ ਕਿਉਂਕਿ ਇਸਦੇ ਬਹੁਤ ਸਾਰੇ ਫਾਇਦੇ ਹਨ ਫਸਟ ਏਡ ਕਿੱਟ ਦੇ ਵਿੱਚ ਸਾਡੇ ਕੋਲ ਓ ਆਰ ਐਸ ਦੇ ਪੈਕਟ ਹੋਣੇ ਚਾਹੀਦੇ ਹਨ ਸਾਡੇ ਕੋਲੇ ਡਰੈਸਿੰਗ ਲਈ ਉਸ ਨਾਲ ਕੈਂਚੀ ਹੋਣੀ ਚਾਹੀਦੀ ਹ ਟੇਪ ਹੋਣੀ ਚਾਹੀਦੀ ਹੈ ਬੀਟਾਡੀਨ ਸਲਿਊਸ਼ਨ ਹੋਣਾ ਚਾਹੀਦਾ ਸਾਡੇ ਕੋਲੇ ਆਮ ਲੋੜੀਦੀਆਂ ਦਵਾਈਆਂ ਹੋਣੀਆਂ ਚਾਹੀਦੀਆਂ ਹਨ ਜਿਵੇਂ ਪੈਰਾਸਿਟਾਮੋਲ ਡਿਕਲੋਫਲੈਕ ਜਿਹੜੀਆਂ ਆਮ ਸਾਡੇ ਰਸਤੇ ਵਿੱਚ ਯੂਜ਼ ਹੁੰਦੀਆਂ ਹਨ ਇਸੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆਂ ਕਿ ਇੱਕ ਵਾਰ ਅਸੀਂ ਹਾਂ ਹੇਮਕੁੰਡ ਸਾਹਿਬ ਆਪਣੇ ਮਾਤਾ ਪਿਤਾ ਨਾਲ ਜਦੋਂ ਗਏ ਸੀ ਤੇ ਉੱਥੇ ਜਦੋਂ ਅਸੀਂ ਗਏ ਤਾਂ ਮੇਰੇ ਮਾਤਾ ਜੀ ਦਾ ਬੀ ਪੀ ਡਾਊਨ ਹੋ ਗਿਆ ਤੇ ਮੈਂ ਮੈਨੂੰ ਇਹ ਪਤਾ ਹੈ ਕਿ ਜਿਹੜਾ ਬੀ ਪੀ ਡਾਊਨ ਹੋਣ ਨਾਲ ਮਤਲਬ ਜਦੋਂ ਅਸੀਂ ਓ ਆਰ ਐਸ ਪੀ ਲੈਂਦੇ ਆ ਤਾਂ ਇਸ ਨਾਲ ਸਾਡਾ ਬੀ ਪੀ